ਹਾਂਜੀ ਕੌਣ ਜੀ ਸਤਿ ਸ਼੍ਰੀ ਅਕਾਲ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਜ਼ਰੂਰ ਜ਼ਰੂਰ ਸਰ ਜ਼ਰੂਰ ਸਰ ਪੰਜਾਬ ਦੀਆਂ ਬਹੁਤ ਵੱਡੀਆਂ ਵੱਡੀਆਂ ਪਰਸਨੈਲਿਟੀਜ਼ ਹੋਈਆਂ ਨੇ ਪਹਿਲਾਂ ਤਾਂ ਅਗਰ ਆਪਾਂ ਗੱਲ ਕਰੀਏ ਦੋ ਤਰ੍ਹਾਂ ਦੀਆਂ ਪਰਸਨੈਲਿਟੀਜ਼ ਹੋਈਆਂ ਨੇ ਇੱਕ ਤਾਂ ਫੋਕ ਆਰਟਿਸਟ ਹੋਏ ਨੇ ਇੱਕ ਕਲਾਸੀਕਲ ਆਰਟਿਸਟ ਹੋਏ ਨੇ ਸਭ ਤੋਂ ਪਹਿਲਾਂ ਅਸੀਂ ਗੱਲ ਕਰੀਏ ਤਾਂ ਫੋਕ ਆਰਟਿਸਟ ਫੋਕ ਆਰਟਿਸਟ ਦੀ ਫੋਕ ਮਿਊਜ਼ਿਕ ਪੰਜਾਬ ਦਾ ਜੋ ਰਿਹਾ ਬਹੁਤ ਹੀ ਜ਼ਿਆਦਾ ਰਿਚ ਰਿਹਾ ਅਤੇ ਇਹਨਾਂ 'ਚ ਸਭ ਤੋਂ ਸੁਨਹਿਰੀ ਅੱਖਰਾਂ 'ਚ ਜਿਹਨੂੰ ਆਪਾਂ ਕਹਿੰਦੇ ਨਾਮ ਆਉਂਦਾ ਲਾਲ ਚੰਦ ਯਮਲਾ ਜੀ ਦਾ ਜਿਹਨਾਂ ਨੂੰ ਯਮਲਾ ਜੱਟ ਜੀ ਦੇ ਨਾਮ ਨਾਲ ਜਾਣਿਆ ਜਾ ਜਾਣਿਆ ਜਾਂਦਾ ਹੈ ਬਹੁਤ ਵੱਡੇ ਫੇਮਸ ਸਿੰਗਰ ਹੋਏ ਨੇ ਹਜ਼ਾਰਾਂ 'ਚ ਹੀ ਉਹਨਾਂ ਦੀਆਂ ਕੈਸਟਾਂ ਕੈਸਟਾਂ ਮਸ਼ਹੂਰ ਹੋਈਆਂ ਸੀਗੀਆਂ ਯੰਗ ਜਨਰੇਸ਼ਨ 'ਚ ਉਸ ਤੋਂ ਇਲਾਵਾ ਗੁਰਮੀਤ ਬਾਬਾ ਜੀ ਹੋਏ ਨੇ ਅਗਰ ਆਪਾਂ ਗੱਲ ਕਰੀਏ ਕਲਾਸੀਕਲ ਮਿਊਜ਼ਿਕ ਦੀ ਕਲਾਸੀਕਲ ਮਿਊਜ਼ਿਕ ਦਾ ਸਭ ਤੋਂ ਵੱਡਾ ਨਾਮ ਆਉਂਦਾ ਹੈ ਉਸਤਾਦ ਬੜੇ ਗੁਲਾਮ ਅਲੀ ਖਾਨ ਸਾਹਿਬ ਜਿਨ੍ਹਾਂ ਦੇ ਹਜ਼ਾਰਾਂ ਹੀ ਸਟੂਡੈਂਟਸ ਹੋਏ ਨੇ ਅਤੇ ਬੋਲੀਵੁੱਡ 'ਚ ਵੀ ਉਹਨਾਂ ਦੀਆਂ ਗਾਈਆਂ ਹੋਈਆਂ ਉਸ ਟਾਈਮ ਦੀਆਂ ਕੰਪੋਜੀਸ਼ਨਸ ਅੱਜ ਮਸ਼ਹੂਰ ਹੋ ਰਹੀਆਂ ਨੇ ਅਤੇ ਜੇ ਆਪਾਂ ਅ ਮਿਊਜ਼ਿਕ ਇੰਸਟਰੂਮੈਂਟਲ ਦੀ ਗੱਲ ਕਰੀਏ ਇੱਕ ਬਹੁਤ ਵੱਡਾ ਨਾਮ ਹੋਇਆ ਉਸਤਾਦ ਜ਼ਾਕਿਰ ਹੁਸੈਨ ਬਹੁਤ ਵੱਡੇ ਮਿਊਜ਼ਿਕ ਆਰਟਿਸਟ ਹੋਏ ਨੇ ਗਰਾਮੀ ਅਵੋਡ ਉਹਨਾਂ ਨੂੰ ਲਗਾਤਾਰ ਤਿੰਨ ਵਾਰੀ ਮਿਲਿਆ ਸੋ ਇਹ ਪੰਜਾਬ ਦਾ ਪੰਜਾਬ ਦਾ ਕੋਂਟਰੀਬਿਊਸ਼ਨ ਰਿਹਾ ਮਿਊਜ਼ਿਕ 'ਚ ਪੰਜਾਬ ਤੋਂ ਬਹੁਤ ਵੱਡੀਆਂ ਵੱਡੀਆਂ ਪਰਸ ਨਾਮੀ ਪਰਸਨੈਲਿਟੀ ਹੋਈਆ ਨੇ ਠੀਕ ਹੈ ਜੀ ਹਾਂਜੀ ਸਰ ਮੈਂ ਹਾਂ ਮੈਂ ਖਾਲਸਾ ਕੋਲੇਜ ਪਟਿਆਲੇ 'ਚ ਟੀਚ ਕਰਦਾ ਜੀ ਤੁਸੀਂ ਜਦੋਂ ਤੁਹਾਨੂੰ ਟਾਈਮ ਮਿਲਦਾ ਮਿਲਦਾ ਸਾਢੇ ਚਾਰ ਤੋਂ ਪਹਿਲਾਂ ਪਹਿਲਾਂ ਮੈਨੂੰ ਆ ਕੇ ਮਿਲ ਸਕਦੇ ਹੋ ਆਪਣੇ ਬੇਟੇ ਨੂੰ ਲੈ ਲਿਆ ਸਕਦੇ ਹੋ ਜੀ ਐਨੀ ਟਾਈਮ ਸਰ ਐਨੀ ਟਾਈਮ

ਜੀ ਸਰ ਓਕੇ ਸਰ ਓਕੇ